ਸਾਡੇ ਮੋਹਾਲੀ ਜ਼ਿਲ੍ਹੇ ਦੇ ਰਵਾਇਤੀ ਪਕਵਾਨ ਜਿਵੇਂ ਸਾਗ ਹੋ ਗਿਆ ਮੱਕੀ ਦੀ ਰੋਟੀ ਹੋ ਗਈ ਮੱਖਣ ਹੋ ਗਿਆ ਦਹੀਂ ਹੋ ਗਿਆ ਪਾਲਕ ਪਨੀਰ ਹੋ ਗਿਆ ਮਟਰ ਪਨੀਰ ਹੋ ਗਿਆ ਇਹ ਸਾਡੇ ਜ਼ਿਲ੍ਹੇ ਦੇ ਰਵਾਇਤੀ ਪਕਵਾਨ ਹਨ ਅਤੇ ਉਹਨਾਂ ਨੂੰ ਤਿਆਰ ਕਰਨ ਵਾਸਤੇ ਜਿੱਦਾਂ ਚੁੱਲ੍ਹਾ ਹੋ ਗਿਆ ਚੁੱਲ੍ਹੇ ਪਰ ਅਸੀਂ ਸਾਗ ਬਣਾਉਂਦੇ ਹੈ ਲੱਸੀ ਹੈ ਅਸੀਂ ਚਾਟੀ 'ਚ ਰਿੜਕਦੇ ਆ ਅਤੇ ਮੱਖਣ ਕੱਢਦੇ ਹਾਂ ਅਤੇ ਆਪਣੇ ਜ਼ਿਲ੍ਹੇ ਦੇ ਸੱਭਿਆਚਾਰਕ ਬਾਰੇ ਪੰਜਾਬੀ ਭੰਗੜਾ ਹੁੰਦਾ ਹੈ ਸਾਡਾ ਪੰਜਾਬੀ ਗਾਇਕੀ ਹੁੰਦੀ ਹੈ ਗਾਣੇ ਹੁੰਦੇ ਹੈ ਅਤੇ ਇੱਥੇ ਦੇ ਲੋਕਾਂ ਦਾ ਚੰਗਾ ਖਾਣਾ ਪੀਣਾ ਸਾਗ ਹੈ ਮੱਕੀ ਦੀ ਰੋਟੀ ਹੈ ਪਾਲਕ ਪਨੀਰ ਹੈ ਮਟਰ ਪਨੀਰ ਹੈ ਅਤੇ ਛੋਲੇ ਵੀ ਹੁੰਦੇ ਹਨ ਦਹੀਂ ਹੈ ਮੱਖਣ ਹੈ ਲੱਸੀ ਹੈ ਇਹ ਸਾਰੇ ਸਾਡੇ ਪੰਜਾਬ ਦਾ ਮਨਭਾਉਂਦਾ ਖਾਣਾ ਹੈ